ਖ਼ਬਰਾਂ ਅਤੇ ਹਕੀਕਤ ਵਿੱਚ ਕੁਝ ਨਾ ਕੁਝ ਅੰਤਰ ਹੁੰਦਾ ਹੈ ਜਿਵੇਂ ਕਿ ਕੁਝ ਜਿਵੇਂ ਕਿ ਕੁਝ ਟੀ ਵੀ ਚੈਨਲ ਆ ਕੁਝ ਖ਼ਬਰਾਂ ਖ਼ਬਰਾਂ ਕੁਝ ਵਧੀਆ ਵੀ ਦਿਖਾਉਂਦੇ ਨੇ ਅਤੇ ਕੁਝ ਫੇਕ ਖ਼ਬਰਾਂ ਹੁੰਦੀਆਂ ਨੇ ਅਤੇ ਇਹ ਕਈ ਵਾਰ ਇੱਦਾਂ ਹੁੰਦਾ ਹੈ ਕਿ ਕੋਈ ਕੋਈ ਖ਼ਬਰ ਐਵੇਂ ਦੀ ਹੁੰਦੀ ਆ ਲੜਾਈ ਝਗੜਾ ਵਾਲੀ ਹੁੰਦੀ ਆ ਜਾਂ ਕੁਝ ਸ਼ਹਿਰ ਵਿੱਚ ਲੜਾਈ ਝਗੜਾ ਹੁੰਦਾ ਵਾ ਤਾਂ ਉਹ ਗੱਲ ਗੱਲ ਹੁੰਦੀ ਵੀ ਨਹੀਂ ਆ ਅਤੇ ਇੱਦਾਂ ਦੇ ਦਿਖਾਇਆ ਜਾਂਦਾ ਵਾ ਅਤੇ ਕਈ ਵਾਰੀ ਇੱਦਾਂ ਹੁੰਦਾ ਵਾ ਕਿ ਕੋਈ ਕੋਈ ਗੱਲ ਕੋਈ ਖ਼ਬਰ ਹੁੰਦੀ ਵੀ ਨਹੀਂ ਆ ਅਤੇ ਉਹ ਉਹਨੂੰ ਵੱਧ ਚੜਾ ਕੇ ਦੱਸਿਆ ਜਾਂਦਾ ਆ ਅਤੇ ਇਸ ਤਰ੍ਹਾਂ ਕਿਸੇ ਦੇ ਪਰਿਵਾਰ 'ਤੇ ਕੋਈ ਮਾਨਸਿਕ ਤਣਾਅ ਆਉਂਦਾ ਵਾ ਉਹਨਾਂ ਦੇ ਬੁਰਾ ਪ੍ਰਭਾਵ ਪੈਂਦਾ ਵਾ ਉਹਨਾਂ ਦੇ ਪਰਿਵਾਰ ਦੇ ਅਤੇ ਇਸ ਤਰ੍ਹਾਂ ਦੀਆਂ ਝੂਠੀਆਂ ਅਤੇ ਫੇਕ ਖਬਰਾਂ ਨਹੀ ਦਿਖਾਉਣੀਆਂ ਚਾਹੀਦੀਆਂ ਅਤੇ ਕੁਝ ਚੈਨਲ ਇੱਦਾਂ ਦੇ ਹੁੰਦੇ ਆ ਕਿ ਬਹੁਤ ਵਧੀਆ ਖ਼ਬਰਾਂ ਦਿਖਾਉਂਦੇ ਆ ਅਤੇ ਬਹੁਤ ਚੰਗੇ ਚੈਨਲ ਨੇ ਤੇ ਉਹ ਉਹਨਾਂ ਦੇ ਬਹੁਤ ਵਧੀਆ ਖ਼ਬਰਾਂ ਵਿਖਾਉਂਦੇ ਨੇ ਜੋ ਸੱਚ ਹੁੰਦੀਆਂ ਨੇ